ਕੁਛ ਸਥਾਨਕ ਪਕਵਾਨ ਅਤੇ ਪਕਵਾਨ ਜੋ ਸੈਲਾਨੀਆਂ ਨੂੰ ਪੰਜਾਬ ਦੇ ਜਾਣ ਵੇਲੇ ਅਜ਼ਮਾਉਣੇ ਚਾਹੀਦੇ ਹਨ ਉਹ ਕੀ ਹੈ ਕਿ ਜਿਸ ਤਰ੍ਹਾਂ ਅੰਮ੍ਰਿਤਸਰ ਦਾ ਕੁਲਚਾ ਹੈਗਾ ਇੱਥੋਂ ਦੀ ਲੱਸੀ ਹੈਗੀ ਹੈ ਅਤੇ ਜੋ ਕਿ ਇੱਥੇ ਬਹੁਤ ਫੇਮਸ ਹੈ ਜਿਹੜਾ ਵੀ ਅੰਮ੍ਰਿਤਸਰ ਆਉਂਦਾ ਹੈ ਉਹਨੂੰ ਚਾਹੇ ਸਾਰੇ ਜਿੰਨੇ ਦਿਨ ਉਹ ਰਹਿੰਦਾ ਉਹਨੂੰ ਕੁਲਚਾ ਖਵਾ ਦਿਉ ਲੱਸੀ ਉਹਨਾਂ ਨੇ ਪੀਣੀ ਪੀਣੀ ਹੈ ਇੱਥੇ ਇੱਥੋਂ ਦਾ ਬਹੁਤ ਜ਼ਿਆਦਾ ਫੇਮਸ ਹੈਗਾ ਇੱਥੇ ਜਿਹੜੇ ਕਿ ਪੰਜਾਬ ਦੇ ਉਹ ਜਿਹੜਾ ਫੇਮਸ ਹੈਗਾ ਉਹ ਹੈ ਮੱਕੀ ਦੀ ਰੋਟੀ ਅਤੇ ਸਰ੍ਹੋਂ ਦਾ ਸਾਗ ਲੋਕ ਇੱਥੇ ਸਪੈਸ਼ਲੀ ਆਹ ਖਾਣ ਆਉਂਦੇ ਆ ਜੋ ਕਿ ਜੋ ਟੇਸਟ ਉਹ ਪੰਜਾਬ 'ਚ ਹੀ ਮਿਲਦਾ ਹੋਰ ਕਿਤੇ ਜਾ ਕੇ ਉਹ ਸੇਮ ਟੇਸਟ ਨਹੀਂ ਮਿਲ ਸਕਦਾ ਲੋਕ ਇੱਥੇ ਜਿਹੜੇ ਟੂਰਿਸਟ ਆਉਂਦੇ ਹੈ ਉਹ ਸਾਡੇ ਗੁਰੂ ਨਗਰੀ ਵਿੱਚ ਦਰਬਾਰ ਸਾਹਿਬ ਵੀ ਜਾਂਦੇ ਉੱਥੇ ਜਿਹੜਾ ਲੰਗਰ ਮਿਲਦਾ ਉਹ ਬਿਨਾ ਫਰੀ ਸੇਵਾ ਹੁੰਦੀ ਹੈ ਉਹਦਾ ਕੋਈ ਪੈਸਾ ਨਹੀਂ ਚਾਰਜ ਹੁੰਦਾ ਅਤੇ ਉਹ ਲੋਕ ਉਹ ਆ ਕੇ ਖਾਂਦੇ ਹਨ ਅਤੇ ਉਹਨਾਂ ਨੂੰ ਉਹ ਵੀ ਬਹੁਤ ਸਵਾਦ ਲੱਗਦਾ ਸਪੈਸ਼ਲੀ ਲੋਕ ਦੂਰੋਂ ਦੂਰੋਂ ਆਉਂਦੇ ਅਤੇ ਲੰਗਰ ਖਾ ਕੇ ਜ਼ਰੂਰ ਜਾਂਦੇ ਜਾਂ ਬਿਲਕੁਲ ਨਿਸ਼ੁਲਕ ਕੋਈ ਪੈਸਾ ਨਹੀਂ ਲਿੱਤਾ ਜਾਂਦਾ ਉਹ ਫਰੀ ਸੇਵਾ ਪੂਰੇ ਦਿਨ ਲੰਗਰ ਚਲਦਾ ਹੈਗਾ ਜੋ ਕਿ ਬਹੁਤ ਵਧੀਆ ਹੈਗਾ ਅਤੇ ਇੱਥੋਂ ਦੇ ਜਿਹੜੇ ਛੋਲੇ ਭਟੂਰੇ ਪੂੜੀ ਛੋਲੇ ਇਹ ਵੀ ਬੜੇ ਫੇਮਸ ਹੈ ਲੋਕ ਇੱਥੇ ਆ ਕੇ ਛੋਲਿਆਂ ਨਾਲ ਉਹਨਾਂ ਨੂੰ ਜੋ ਜੋ ਮਰਜ਼ੀ ਦੇ ਦਿਉ ਕੁਲਚਾ ਹੈ ਜੋ ਕਿ ਉਹ ਵੀ ਬਹੁਤ ਖਾਂਦੇ ਹਨ ਸਪੈਸ਼ਲੀ ਜਿਹੜਾ ਕਿ ਪੰਜਾਬ ਦਾ ਫੇਮਸ ਜੋ ਟੇਸਟ ਅਤੇ ਸੁਆਦ ਪੰਜਾਬ ਦਾ ਹੈਗਾ ਉਹ ਕਿਤੇ ਵੀ ਨਹੀਂ ਹੈਗਾ ਉਹ ਤੁਸੀਂ ਕਿਤੇ ਵੀ ਚਲੇ ਜਾਓ ਸੇਮ ਤੁਹਾਨੂੰ ਪੰਜਾਬ ਦਾ ਟੇਸਟ ਨਹੀਂ ਮਿਲੇਗਾ ਮੱਕੀ ਅਤੇ ਸਰਸੋਂ ਦੇ ਪਿੰਡਾਂ ਵਿੱਚ ਇੰਨਾ ਸਵਾਦ ਬਣਾਇਆ ਜਾਂਦਾ ਇੰਨਾ ਘਿਓ ਪਾ ਕੇ ਖਾਧਾ ਜਾਂਦਾ ਹੈ ਜੋ ਕਿ ਬਹੁਤ ਸਵਾਦ ਹੁੰਦਾ ਹੈ ਬਸ ਇਹੋ ਆ ਸਾਰੇ ਆ ਜਿਹੜੇ ਅਜ਼ਮਾਉਣੇ ਚਾਹੀਦੇ ਆ ਜੋ ਵੀ ਇੱਥੇ ਆਉਣ ਤਾਂ ਕੁਲਚਾ ਲੱਸੀ ਗੁਰੂ ਘਰ ਦਾ ਲੰਗਰ ਜ਼ਰੂਰ ਛਕ ਕੇ ਜਾਵੇ